ਤੁਸੀਂ ਪਹਿਲਾਂ ਕਿਹੜੇ ਕੰਮ ਕਰਦੇ ਸੀ ਪਰ ਹੁਣ ਲਈ ਉਸ ਕੰਮ ਲਈ ਤਕ ਤਕਨੋਲੋਜੀ 'ਤੇ ਭਰੋਸਾ ਕਰਦੇ ਹੋ ਅਸੀਂ ਸਭ ਤੋਂ ਵਧੀਆ ਖੇਤੀਬਾੜੀ ਲਈ ਪਹਿਲਾਂ ਹੱਥੀਂ ਕੰਮ ਕਰਦੇ ਤੇ ਅਤੇ ਹੁਣ ਮਸ਼ੀਨਾਂ ਆ ਗਈਆਂ ਰੂਟਾਵੇਟਰ ਪਹਿਲਾਂ ਕਹੀ ਨਾਲ ਵਾਹੁਣਾ ਪੈਂਦਾ ਤਾ ਕ ਕਹੀ ਨਾਲ ਪਹਿਲਾਂ ਟਰੈਕਟਰ ਹਲ ਚੱਲਦੇ ਤੇ ਹੁਣ ਤਾਂ ਅਲੱਗ ਅਲੱਗ ਤਰ੍ਹਾਂ ਦੀਆਂ ਮਸ਼ੀਨਰੀ ਆਹ ਆ ਗਈ ਵੀ ਬਿਜਾਈ ਵੀ ਆਪਣੇ ਆਪ ਏ ਹੋ ਜਾਂਦੀ ਹੈ ਝੋਨੇ ਦੀ ਅੱਗੇ ਹੱਥਾਂ ਨਾਲ ਲਾਉਂਦੇ ਤੇ ਮਤਲਬ ਲਾਉਂਦੇ ਤਾਂ ਹੁਣ ਵੀ ਪਿੰਡਾਂ 'ਚ ਹੱਥਾਂ ਨਾਲ ਪਰ ਬਹੁਤ ਹੀ ਕਿਸਾਨਾਂ ਨੇ ਜਿਹੜੇ ਤਕੜੇ ਕਿਸਾਨ ਆ ਉਹਨਾਂ ਨੇ ਆਪਣੀ ਕਿਸਾਨੀ ਨੂੰ ਕਿਸਾਨੀ ਨੂੰ ਜਾਂ ਖੇਤੀਬਾੜੀ ਨੂੰ ਆਸਾਨ ਕਰਨ ਲਈ ਹੁਣ ਮਸ਼ੀਨਾਂ ਦਾ ਸਹਾਰਾ ਲਿਆ ਅਤੇ ਮਸ਼ੀਨਾਂ ਦਾ ਫਾਇਦਾ ਵੀ ਆ ਅਤੇ ਸੌ ਸੌ ਕੀਲਿਆਂ ਦੀ ਖੇਤੀ ਉਹ ਕੁਛ ਆਸਾਨ ਕ ਦ ਆਸਾਨ ਆਸਾਨ ਤਰੀਕੇ ਨਾਲ ਕੰਮ ਦੇ ਵਿੱਚ ਹੀ ਕਰ ਦਿੰਦੀਆਂ ਮਸ਼ੀਨਾਂ ਉਹਨਾਂ ਦੀਆਂ ਮਤਲਬ ਕਾਫੀ ਬੰਦੇ ਦਾ ਕੰਮ ਇੱਕ ਮਸ਼ੀਨ ਏ ਕਰ ਦਿੰਦੀ ਆ ਸੋ ਟੈਕਨੋਲਜੀ 'ਤੇ ਭਰੋਸਾ ਹੈਗਾ